ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਦੇ ਬਹੁਤ ਸਾਰੇ ਫਾਇਦੇ ਹਨ ਇਹ ਸਿਰਫ਼ ਇੱਕ ਖੇਡ ਹੀ ਨਹੀਂ ਇਹ ਇੱਕ ਪੂਰੇ ਸਰੀਰ ਦੀ ਇੱਕ ਪੂਰੀ ਕਸਰਤ ਵੀ ਹੈ ਇਹ ਦਿਲ ਮਨ ਮਾਸਪੇਸ਼ੀਆਂ ਦੇ ਤਣਾਅ ਨੂੰ ਦੂਰ ਕਰਨ ਲਈ ਬਹੁਤ ਵਧੀਆ ਉਪਾਅ ਹੈ ਪੂਰੇ ਸਰੀਰ ਦੀ ਕਸਰਤ ਤੈਰਾਕੀ ਦੌਰਾਨ ਹੱਥ ਪੈਰ ਪਿੱਠ ਮਾਸਪੇਸ਼ੀਆਂ ਅਤੇ ਦਿਲ ਸਭ ਨੂੰ ਕੰਮ ਕਰਨਾ ਪੈਂਦਾ ਹੈ ਇਹ ਮਜ਼ਬੂਤ ਮਾਸਪੇਸ਼ੀਆਂ ਜੋੜ ਅਤੇ ਸ਼ਕਤੀਸ਼ਾਲੀ ਹੱਡੀਆਂ ਬਣਾਉਂਦੀਆਂ ਹਨ ਦਿਲ ਅਤੇ ਫੇਫੜਿਆਂ ਦੇ ਮਜ਼ਬੂਤੀਆਂ ਵੀ ਕਰਦੇ ਹਨ ਤੈਰਾਕੀ ਦਿਲ ਦੀ ਧੜਕਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਂਦੀ ਹੈ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਹਰਟ ਦੀ ਬਿਮਾਰੀਆਂ ਨੂੰ ਘਟਾਉਂਦੀ ਹੈ ਤੈਰਾਕੀ ਚਰਬੀ ਘਟਾਉਣ ਵਿੱਚ ਵੀ ਮਦਦ ਕਰਦੀ ਹੈ ਤ ਤਣਾਅ ਘਟਾਉਣ ਅਤੇ ਮਨ ਦੀ ਸ਼ਾਂਤੀ ਵੀ ਇਸ ਨਾਲ ਹੁੰਦੀ ਹੈ ਸਾਹ ਨਿਰੰਤਰਣ ਵਿੱਚ ਵੀ ਬਹੁਤ ਮਦਦ ਹੁੰਦੀ ਹੈ ਤੈਰਾਕੀ ਦੌਰਾਨ ਹਵਾ ਦੀ ਆਵਾਜਾਈ 'ਤੇ ਧਿਆਨ ਦੇਣਾ ਪੈਂਦਾ ਹੈ ਜਿਸ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ ਸਾਹ ਲੈਣ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧਾਉਂਦੀ ਹੈ ਇਹ ਅਸਥਮਾ ਵਾਲੇ ਲੋਕਾਂ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ ਧੰਨਵਾਦ ਜੀ